ਮੈਂ ਆਪਣੇ ਰੋਜ਼ਾਨਾ ਜੀਵਨ ਦੇ ਵਿੱਚ ਡਰਾਇੰਗ ਦੀ ਪ੍ਰੇਰਨਾ ਜਿੱਦਾਂ ਕਿ ਆਪਣੇ ਘਰਾਂ ਦੇ ਵਿੱਚ ਫੁੱਲ ਲੱਗੇ ਹੁੰਦੇ ਹਨ ਅਤੇ ਉਹ ਬਹੁਤ ਹੀ ਜ਼ਿਆਦਾ ਧੁੱਪ ਦੀ ਰੋਸ਼ਨੀ ਨਾਲ ਚਮਕਦੇ ਹਨ ਜਾਂ ਫਿਰ ਬਾਰਿਸ਼ ਦੇ ਮੌਸਮ ਦੇ ਵਿੱਚ ਬੱਚੇ ਖੇਡਦੇ ਹੋਏ ਬਹੁਤ ਹੀ ਜ਼ਿਆਦਾ ਸੋਹਣੇ ਲੱਗਦੇ ਹਨ ਮੈਂ ਇਨ ਇਹੋ ਜਿਹੀਆਂ ਚੀਜਾਂ ਦੀ ਪ੍ਰੇਰਨਾ ਲੈਂਦੀ ਹਾਂ ਅਤੇ ਜੇ ਗੱਲ ਕਰੀਏ ਕਲਪਨਾ ਦੀ ਤਾਂ ਜਦੋਂ ਮੈਂ ਡਰਾਇੰਗ ਕਰਦੀ ਹਾਂ ਤਾਂ ਜੋ ਮੈਂ ਸੋਚਦੀ ਹਾਂ ਉਹ ਜ਼ਿੰਦਗੀ ਦੀ ਅਸਲੀਅਤ ਤੋਂ ਬਹੁਤ ਹੀ ਜ਼ਿਆਦਾ ਖੂਬਸੂਰਤ ਹੁੰਦਾ ਹੈ ਅਤੇ ਇਹ ਮੇਰੇ ਲਈ ਇੱਕ ਬਹੁਤ ਹੀ ਜ਼ਿਆਦਾ ਖੁਸ਼ੀ ਦਾ ਮਾਹੌਲ ਹੁੰਦਾ ਹੈ ਜਦੋਂ ਮੈਂ ਡਰਾਇੰਗ ਕਰਦੀ ਹਾਂ ਡਰਾਇੰਗ ਕਰਨ ਨਾਲ ਮੇਰੀ ਟੈਂਸ਼ਨ ਵੀ ਬਹੁਤ ਜ਼ਿਆਦਾ ਘੱਟ ਜਾਂਦੀ ਹੈ ਅਤੇ ਮੈਨੂੰ ਬਹੁਤ ਹੀ ਰਿਲੀਫ ਮਿਲਦਾ ਹੈ ਮੈਂ ਬਚਪਨ ਤੋਂ ਹੀ ਡਰਾਇੰਗ ਕਰਨਾ ਮੈਨੂੰ ਪਸੰਦ ਹੈ ਅਤੇ ਮੈਂ ਡਰਾਇੰਗ ਕਰਕੇ ਆਪਣੀ ਸਾਰੀ ਥਕਾਵਟ ਦੂਰ ਕਰ ਲੈਂਦੀ ਹਾਂ ਕਈ ਵਾਰ ਜਦੋਂ ਬਾਰਿਸ਼ ਚੱਲ ਰਹੀ ਹੁੰਦੀ ਹੈ ਤਾਂ ਉਸ ਵਿੱਚ ਥੋੜ੍ਹਾ ਟਾਈਮ ਰੁਕਦੀ ਹੈ ਅਤੇ ਉਸਦਾ ਵਿਊ ਥੋੜ੍ਹਾ ਜਿਹਾ ਅੱਧੇ ਬੱਦਲ ਅੱਧੇ ਸੂਰਜ ਦਿਖਾਈ ਦਿੰਦੇ ਹਨ ਅਤੇ ਹ ਹਰੀ ਹਰੀ ਘਾਹ ਅਤੇ ਖੇਤਾਂ ਵਿੱਚ ਲੱਗੀਆਂ ਹੋਈਆਂ ਫਸਲਾਂ ਜੋ ਕਿ ਚਮਕਦੀਆਂ ਹਨ ਬਹੁਤ ਹੀ ਸੋਹਣੀਆਂ ਲੱਗਦੀਆਂ ਹਨ ਅਤੇ ਮੈਂ ਇੱਦਾਂ ਦਾ ਕੁਛ ਡਰਾਇੰਗ ਕਰਨਾ ਹੀ ਪਸੰਦ ਕਰਦੀ ਹਾਂ ਅਤੇ ਮੈਨੂੰ ਡਰਾਇੰਗ ਕਰਨਾ ਬਹੁਤ ਹੀ ਜ਼ਿਆਦਾ ਪਸੰਦ ਹੈ ਥੈਂਕ ਯੂ